ਜੇਕਰ ਸਿੱਖਿਆ ਦੇ ਨਾਲ ਨਾਲ ਧਾਰਮਿਕ ਸਿੱਖਿਆ ਮਿਲਣ ਲੱਗ ਜਾਏ ਤਾਂ ਬਹੁਤ ਵਧੀਆ ਇੱਕ ਫਾਇਦਾ ਹੋ ਜੂਗਾ ਬਹੁਤ ਬਹੁਤ ਲਾਭ ਹੋਊਗਾ ਇਸ ਚੀਜ਼ ਦਾ ਅੱਗੇ ਜਾ ਕੇ ਬੱਚਾ ਕਿਸੇ ਮਾੜੇ ਕੰਮ ਨਹੀਂ ਲੱਗੂਗਾ ਉਹ ਬੱਚੇ ਨੂੰ ਛੋਟੇ ਹੁੰਦੇ ਤੋ ਹੀ ਪਤਾ ਲੱਗ ਜੂਗਾ ਵੀ ਸਾਡੇ ਚਾਹੇ ਬੱਚਾ ਕਿਸ ਧਰਮ ਦਾ ਵੀ ਆ ਸਿੱਖ ਆ ਹਿੰਦੂ ਆ ਜਿਸ ਵੀ ਧਰਮ ਦਾ ਬੱਚੇ ਨੂੰ ਉਸ ਇੱਕ ਇਹੋ ਜਿਹਾ ਕੋਈ ਪੀਰੀਅਡ ਹੋਵੇ ਜਿਸ 'ਚ ਉਸ ਬੱਚੇ ਨੂੰ ਉਹ ਜਿਸ ਧਰਮ ਦਾ ਵੀ ਆ ਜਿਸ 'ਚ ਉਹਦੀ ਰੁਚੀ ਆ ਬੱਚੇ ਦੀ ਜਿਸ ਧਰਮ 'ਚ ਉਸ ਧਰਮ ਬਾਰੇ ਦੱਸਿਆ ਜਾਵੇ ਵੀ ਇਹ 'ਚ ਆਹ ਚੰਗੀਆਂ ਚੀਜ਼ਾਂ ਨੇ ਆਹ ਐਵੇਂ ਹੋਇਆ ਇਤਿਹਾਸ ਆ ਇਹ ਕੁਰਬਾਨੀਆਂ ਨੇ ਸਾਡੇ ਧਰਮ ਦੀਆਂ ਅਤੇ ਜਿਹੜੇ ਵੀ ਉਸਦੇ ਧਾਰਮਿਕ ਪਵਿੱਤਰ ਗ੍ਰੰਥ ਨੇ ਉਸ ਬੱਚੇ ਨੂੰ ਪੜ੍ਹਾਏ ਜਾਣ ਪੜ੍ਹਾਏ ਨਾ ਜਾਣ ਮਤਲਬ ਸਮਝਾਏ ਜਾਣ ਕੱਲਾ ਰੱਟਾ ਨਹੀਂ ਕਰਾਉਣਾ ਮਤਲਬ ਸਮਝਾਏ ਜਾਣ ਵੀ ਹਾਂ ਆਹ ਤੁੱਕ ਦਾ ਆਹ ਮਤਲਬ ਆ ਆ ਇਸ ਚੀਜ਼ ਲਈ ਲਿਖੀ ਆ ਇਸ ਚੀਜ਼ ਨਾਲ ਬੱਚੇ ਦਾ ਮਾਈਂਡ ਸੈੱਟ ਚੇਂਜ ਹੋਜੂਗਾ ਉਹ ਚੰਗਾ ਮਾੜਾ ਸਮਝ ਜੂਗਾ ਉਹਨੂੰ ਪਤਾ ਲੱਗੂਗਾ ਵੀ ਕੀ ਕਰਨਾ ਚਾਹੀਦਾ ਕੀ ਨਹੀਂ ਕੀ ਚੰਗਾ ਇਹ ਚੀਜ਼ਾਂ ਕਾਹਤੋਂ ਲਿਖੀਆਂ ਨੇ ਵੀ ਆਹ ਕੁਰਬਾਨੀਆਂ ਹੋਈਆਂ ਨੇ ਆਹ ਚੀਜ਼ਾਂ ਤੋਂ ਮੈਨੂੰ ਦੂਰ ਰਹਿਣਾ ਚਾਹੀਦਾ ਇਸ ਚੀਜ਼ ਨਾਲ ਇੱਕ ਬਹੁਤ ਵੱਡਾ ਚੇਂਜ ਆਜੂਗਾ ਬਹੁਤ ਕ੍ਰਾਈਮ ਵੀ ਘੱਟ ਸਕਦਾ ਕਿਉਂਕਿ ਅਗਰ ਆ ਕੋਈ ਰੱਬ ਲੜ ਲੱਗਾ ਕੋਈ ਮਾੜਾ ਕੰਮ ਨਹੀਂ ਕਰਦਾ ਇਸ ਚੀਜ਼ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਜੇਕਰ ਇਹ ਚੀਜ਼ ਸਰਕਾਰ ਐਡ ਕਰ ਦਿੰਦੀ ਆ ਇੱਕ ਰੈਵੋਲਿਊਸ਼ਨਲੀ ਕੰਮ ਹੋਜੂਗਾ ਇਹ ਬਹੁਤ ਬਹੁਤ ਫਾਇਦਾ ਹੋ ਬੱਚਿਆਂ ਨੂੰ ਸਰਕਾਰ ਨੂੰ ਹਰ ਬੰਦੇ ਨੂੰ ਇਸਦਾ ਬਹੁਤ ਫਾਇਦਾ ਹੋਊਗਾ